ਹੈਲੋ ਹਾਂਜੀ ਤਰਸੇਮ ਸਿੰਘ ਬੋਲ ਰਿਹਾ ਹਾਂਜੀ ਆਪ ਕੌਣ ਹਾਂਜੀ ਹਾਂਜੀ ਹਾਂਜੀ ਮੇਰੀ ਗ੍ਰੈਜੂਏਸ਼ਨ ਹਾਂਜੀ ਹਾਂਜੀ ਮੇਰੀ ਗ੍ਰੈਜੂਏਸ਼ਨ ਇਸ ਦੇ ਵਿੱਚ ਹੀ ਪੂਰੀ ਹੋਈ ਹੈ ਮੈਂ ਐਮ ਏ ਪੰਜਾਬੀ ਵੀ ਕੀਤੀ ਹੋਈ ਹੈ ਹਾਂਜੀ ਇਹ ਕਾਲਜ ਦਾ ਮਾਹੌਲ ਬਹੁਤ ਵਧੀਆ ਹੈਗਾ ਹਾਂਜੀ ਹਾਂਜੀ

ਹਾਂਜੀ ਹਾਂਜੀ ਇ ਇੱਥੇ ਜਿੰਨੇ ਵੀ ਟੀਚਰ ਹੈਗੇ ਲੈਕਚਰਾਰ ਹੈਗੇ ਆ ਉਹ ਬਹੁਤ ਹੀ ਵਧੀਆ ਮੰਨ ਲਓ ਗੁਰਪ੍ਰੀਤ ਵੀ ਮੇਰੇ ਤੋਂ ਥੋੜ੍ਹਾ ਪਿੱਛੇ ਸੀ ਇਕ ਇੱਕ ਦੋ ਕਲਾਸ ਪਿੱਛੇ ਸੀਗੇ ਤੁਹਾਡੇ ਫਰੈਂਡ ਹਾਂਜੀ ਤਾਂ ਹੀ ਉਹਨਾਂ ਨੇ ਤੁਹਾਨੂੰ ਮੇਰਾ ਨੰਬਰ ਦਿੱਤਾ ਅਤੇ ਜਿਨ੍ਹਾਂ ਨਹੀਂ ਜੀ ਇੱਥੇ ਇੱਥੇ ਇੱਥੋਂ ਇਸ ਕਾਲਜ ਦਾ ਮਾਹੌਲ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਇੱਥੇ ਨਸ਼ੇ ਪੱਤੇ ਵਾਲਿਆਂ ਨੂੰ ਤਾਂ ਵੈਸੇ ਉਹ ਦੇਖ ਹੀ ਲੈਂਦੇ ਟੀਚਰ ਇੰਟਰਵਿਊ ਲੈ ਕੇ ਫਿਰ ਐਡਮਿਸ਼ਨ ਕਰਦੇ ਆ ਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕੁੱਲ ਮਿਲਾ ਕੇ ਇੱਥੇ ਇੱਥੋਂ ਦੇ ਟੀਚਰ ਇੱਥੋਂ ਦਾ ਪੂਰਾ ਸਟਾਫ ਅਤੇ ਮਤਲਬ ਸਟੂਡੈਂਟ ਬਹੁਤ ਹੀ ਵਧੀਆ ਹੈਗੇ ਆ ਚੰਗੇ ਪੜ੍ਹਨ ਵਾਲੇ ਹੈਗੇ ਆ ਹਾਂਜੀ ਹਾਂਜੀ ਇਸ ਜਗ੍ਹਾ 'ਤੇ ਮੰਨ ਲਓ ਸੁਰਜੀਤ ਸਿੰਘ ਸੁ ਹਾਂਜੀ ਸੁਰਜੀਤ ਸਿੰਘ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸੁਰਜੀਤ ਸਿੰਘ ਟੀਚਰ ਸੀਗੇ ਮੇਰੇ ਲੈਕਚਰਰ ਸੀਗੇ ਹਰਜੋਤ ਮੈਡਮ ਸੀ ਮਨ ਲਓ ਕੁਲਵਿੰਦਰ ਮੈਡਮ ਸੀ ਮੰਨ ਲਓ ਇੱਕ ਹਰਵਿੰਦਰ ਟੀਚਰ ਸੀਗੇ ਲੈਕਚਰਾਰ ਹਾਂਜੀ ਇਹ ਕਦੇ ਵੀ ਇਹਨਾਂ ਨੇ ਮੰਨ ਲਓ ਆਪਣਾ ਲੈਕਚਰ ਮਿਸ ਨਹੀਂ ਕੀਤਾ ਅਤੇ ਸਾਨੂੰ ਵਧੀਆ ਅਤੇ ਸੌਖੇ ਢੰਗ ਨਾਲ ਮੰਨ ਲਓ ਸਟਡੀ ਕਰਵਾਉਂਦੇ ਸੀਗੇ ਅਤੇ ਇੱਥੋਂ ਦਾ ਰਿਜ਼ਲਟ ਨੱਬੇ ਪਰਸੈਂਟ ਦੇ ਕਰੀਬ ਨੱਬੇ ਤੋਂ ਨਾਇੰਟੀ ਨਾਇਨ ਜੀ ਨੜਿੰਨਵੇਂ ਪਰਸੈਂਟ ਦੇ ਵਿੱਚ ਆਉਂਦਾ ਗਾ ਅਤੇ ਹਾਂਜੀ ਇੱਥੋਂ ਦਾ ਮਾਹੌਲ ਬਹੁਤ ਹੀ ਵਧੀਆ ਇਸ ਟਾਈਮ ਮੇਰਾ ਭਤੀਜਾ ਵੀ ਮਨਿੰਦਰ ਇੱਥੇ ਪੜ੍ਹ ਰਿਹਾ ਹੈਗਾ ਅਤੇ ਮੈਂ ਵੀ ਇੱਥੇ ਐਡਮਿਸ਼ਨ ਉਸ ਦੀ ਇਸ ਕਰਕੇ ਹੀ ਕਰਾਈ ਹੈ ਕਿਉਂਕਿ ਇੱਥੋਂ ਦਾ ਮਾਹੌਲ ਚੰਗਾ ਇੱਥੋਂ ਦਾ ਵਾਤਾਵਰਨ ਚੰਗਾ ਅਤੇ ਟੀਚਰ ਸਟਡੀ ਵਧੀਆ ਕਰਵਾਉਂਦੇ ਆ ਅਤੇ ਇੱਥੋਂ ਦੇ ਤਕਰੀਬਨ ਇੱਥੋਂ ਪੜ੍ਹੇ ਸਟੂਡੈਂਟ ਸੌ ਪਰਸੈਂਟਲੀ ਜੋਬ ਮਿਲ ਹੀ ਜਾਂਦੀ ਹੈ ਨਹੀਂ ਜੋਬ ਮਿਲਦੀ ਤਾਂ ਉਹ ਆਪਣਾ ਚੰਗਾ ਕਾਰੋਬਾਰ ਸਟਾਰਟ ਕਰ ਲੈਂਦੇ ਹਾਂਜੀ ਹਾਂਜੀ ਹਾਂਜੀ ਥੈਂਕ ਯੂ ਓਕੇ